ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਮ ਅੱਛਾ ਜੀ ਹਾਂਜੀ ਮੈਮ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਵੈਸੇ ਮੈਂ ਪੰਜਾਬੀ ਯੂਨੀਵਰਸਿਟੀ

ਇਹਦੇ ਵਿੱਚ ਗੌਰਮੈਂਟ ਨੇ ਇਹ ਇਸਦੇ ਅੰਦਰ ਹੀ ਕੇ ਵੀ ਸਕੂਲ ਮਤਲਬ ਬਹੁਤ ਅੱਗੇ ਬੱਚਿਆਂ ਨੂੰ ਉਹ ਹੋ ਗਿਆ ਅਤੇ ਮਹਾਰਾਜਾ ਰ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਉੱਥੇ ਬਹੁਤ ਚੰਗੀਆਂ ਚੰਗੀਆਂ ਯੂਨੀਵਰਸਿਟੀਆਂ ਮੈਡਮ ਹੋ ਚੁੱਕੀ ਔਨਲਾਈਨ ਸਿਸਟਮ ਜਿਹੜਾ ਸਰਕਾਰ ਦਾ ਬਹੁਤ ਵਧੀਆ ਹੋ ਹੈਗਾ ਹਾਂਜੀ ਹਾਂਜੀ ਹਾਂਜੀ ਅਗਰ ਕੋਈ ਕਦੇ ਮਤਲਬ ਕੋਈ ਵੀ ਕਰੋਨਾ ਜਿਵੇਂ ਪਿਛਲੇ ਟਾਈਮ ਕਰੋਨਾ ਆ ਗਿਆ ਬੱਚਿਆਂ ਦੀ ਔਨਲਾਈਨ ਹੋਈ ਸੀ ਮੈਮ ਸਰਕਾਰ ਦਾ ਇਹ ਬਹੁਤ ਵਧੀਆ ਪੋਲਿਸੀ ਸੀ ਵੀ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਹੀਂ ਹੋਈ ਹਾਂਜੀ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਬਿਲਕੁਲ ਵੀ ਨਹੀਂ ਹਾਂਜੀ ਹਾਂਜੀ ਹਾਂਜੀ ਸਾਰਾ ਪ੍ਰੋਜੈਕਟ ਦਾ ਯੂਨੀਵਰਸਿਟੀ ਸੈਂਟਰ ਯੂਨੀਵਰਸਿਟੀ ਦੀ ਗੱਲ ਕਰਾਂ ਤਾਂ ਪ੍ਰੋਜੈਕਟ ਦਾ ਵੀ ਕੰਮ ਕ ਚਲਦਾ ਇੱਥੇ ਔਨਲਾਈਨ ਲੈਬਸ ਤੁਸੀਂ ਆਓ ਕਦੇ ਇੱਧਰ ਤਾਂ ਤੁਸੀਂ ਦੇਖੋ ਵੀ ਸਰਕਾਰ ਦੀਆਂ ਬਹੁਤ ਚੰਗੀਆਂ ਪੋਲਸੀਆਂ ਨੇ ਇੱਧਰ ਪੰਜਾਬ ਦੇ ਵਿੱਚ ਹਾਂਜੀ ਫਰੀ ਸਕੂਲ ਹੁੰਦੇ ਆ ਉਹਨਾਂ ਨੂੰ ਵਰਦੀਆਂ ਪ੍ਰੋਵਾਈਡ ਹੁੰਦੀਆਂ ਸ਼ੂਜ ਸਰਕਾਰ ਵੱਲੋਂ ਕਿਤਾਬਾਂ ਫਰੀ ਹੈ ਹਾਂਜੀ ਸਾਰੀ ਸਰਕਾਰ ਵੱਲੋਂ ਹਾਂਜੀ ਜਿਵੇਂ ਯੂਨੀਵਰਸਿਟੀ 'ਚ ਉਹਨਾਂ ਦੇ ਪੇਰੈਂਟਸ ਕੰਮ ਕਰਦੇ ਆ ਬੱਚਿਆਂ ਲਈ ਡੇ ਕੇਅਰ ਹੈ ਉਹਨਾਂ ਲਈ ਉਹਨਾਂ ਲਈ ਉਹ ਬੱਚੇ ਸਕੂਲ ਸਕੂਲ ਟਾਈਮ ਸਕੂਲ ਦੇ ਵਿੱਚ ਉਸ ਤੋਂ ਬਾਅਦ ਜੇ ਪੇਰੈਂਟ ਜੋਬ 'ਤੇ ਆ ਉਸ ਤੋਂ ਬਾਅਦ ਉਹ ਡੇ ਕੇਅਰ ਆ ਸਾਰਾ ਕੁਛ ਹੈ ਮੈਮ ਹਾਂਜੀ ਕੋਈ ਗੱਲ ਨਹੀਂ ਮੈਡਮ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਨੂੰ ਫੋਨ ਕਰਨ ਲਈ